ਹਾਂ ਮੈਂ ਬੱਸ ਵਿੱਚ ਸਫ਼ਰ ਕੀਤਾ ਅਸੀਂ ਬੱਸ ਵਿੱਚ ਬ੍ਰਿੰਦਾਵਨ ਗਏ ਅਸੀਂ ਸਾਡੇ ਘਰ ਦੇ ਨੌਂ ਦਸ ਮੈਂਬਰ ਸਨ ਅਤੇ ਅਸੀਂ ਸਾਰੇ ਮ ਸਾਰੇ ਮੈਂਬਰ ਬੜੀ ਵਧੀਆ ਸੀਟਾਂ ਬਹੁਤ ਅੱਛੀ ਬੱਸ ਦੀ ਕੰਡੀਸ਼ਨ ਸੀਗੀ ਅਤੇ ਅਸੀਂ ਬੱਸ ਵਿੱਚ ਸਫ਼ਰ ਬੱਸ ਦੀਆਂ ਬਵੰਜਾ ਸੀਟਾਂ ਸਨ ਮੈਂ ਅਤੇ ਮੇਰੀ ਬੇਟੀ ਅਸੀਂ ਦੋ ਦੋ ਸੀਟਾਂ ਵਾਲੀ ਬੱਸ ਸੀਟ 'ਤੇ ਬੈਠੇ ਬੜਾ ਮਜ਼ਾ ਆਇਆ ਅੱਧੇ ਰਸਤੇ ਸੁੱਤੇ ਗਏ ਸੀਟਾਂ ਬਹੁਤ ਵਧੀਆ ਸਨ ਅਤੇ ਚਾਰ ਪੰਜ ਸਾਡੇ ਪਾਸ ਬੈਗ ਸੀ ਅਤੇ ਅਸੀਂ ਕੁਛ ਬੈਗ ਸੀਟ ਦੇ ਵਿੱਚ ਰੱਖ ਥੱਲੇ ਰੱਖ ਦਿੱਤੇ ਅਤੇ ਇੱਕ ਦੋ ਬੈਗ ਅਸੀਂ ਪਿੱਛੇ ਉਹਦੇ ਵਿੱਚ ਰੱਖ ਦਿੱਤੇ ਡਿੱਗੀ ਵਿੱਚ ਰੱਖ ਦਿੱਤੇ ਰਸਤੇ ਵਿੱਚ ਅਸੀਂ ਭਜਨ ਕੀਰਤਨ ਕਰਦੇ ਗਏ ਬਹੁਤ ਵਧੀਆ ਡਰੈਵਰ ਨੇ ਬੱਸ ਬਹੁਤ ਅੱਛੀ ਚਲਾਈ ਕੋਈ ਝਟਕਾ ਨਹੀਂ ਕੋਈ ਕਿਤੇ ਅਸੀਂ ਡਿਸਟਰਬ ਨਹੀਂ ਹੋਏ ਹੈ ਸਾਡੇ ਨਾਲ ਸਾਡੇ ਨਾਲ ਸਾਡੇ ਨੌਂ ਦਸ ਮੈਂਬਰ ਘਰ ਦੇ ਸਨ ਅਤੇ ਅਸੀਂ ਸਾਰਿਆਂ ਨੇ ਰਸਤੇ ਵਿੱਚ ਭਜਨ ਕੀਰਤਨ ਵੀ ਕੀਤਾ ਅਤੇ ਅਸੀਂ ਫੁੱਲ ਮਜ਼ਾ ਕੀਤਾ ਅਤੇ ਅਸੀਂ ਬੜੀ ਵਧੀਆ ਡਰੈਵਰ ਨੇ ਡਰੈ ਬੱਸ ਚਲਾਈ ਅਤੇ ਅਸੀਂ ਬਹੁਤ ਸਾਨੂੰ ਬੱਸ ਵਿੱਚ ਸਫ਼ਰ ਕਰਕੇ ਬਹੁਤ ਮਜ਼ਾ ਆਇਆ ਬੱਸ ਬੋ ਬੱਸ ਅਤੇ ਹੋਰ ਬਾਕੀ ਯਾਤਰੀ ਵੀ ਬਹੁਤ ਅੱਛੇ ਸਨ ਸਾਰੇ ਹੱਸੀ ਹੱਸੀ ਖੁਸ਼ੀ ਖੁਸ਼ੀ ਬ੍ਰਿੰਦਾਵਨ ਗਏ